ਹੈਲੋ ਹਾਂਜੀ ਹਾਂਜੀ ਹੋਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਬੇਟਾ ਠੀਕ ਹੋ ਬਸ ਵਧੀਆ ਜੀ ਵਧੀਆ ਉਹ ਮੈਨੂੰ ਨੰਬਰ ਤੁਸੀਂ ਮੇਰਾ ਨੰਬਰ ਦਿੱਤਾ ਸੀ ਤੁਹਾਨੂੰ ਕਿਸੇ ਨੇ ਠੀਕ ਹੈ ਜੀ ਠੀਕ ਹੈ ਹੋਰ ਬਸ ਵਧੀਆ ਵਧੀਆ ਤੁਸੀਂ ਦੱਸੋ ਕਿਵੇਂ ਚੱਲਦੀ ਹੈ ਤੁਹਾਡੀ ਪ੍ਰੈਕਟਿਸ ਗੇਮ ਵਗੈਰਾ ਲਾਉਂਦੇ ਕੀ ਕੀ ਐਕਟੀਵਿਟੀ ਕਰਦੇ ਹੋ ਸਾਰੇ ਦਿਨ 'ਚ ਦੱਸੋ ਮੈਨੂੰ ਜਰਾ ਡਿਟੇਲ 'ਚ ਕਦੋਂ ਸੁਬਹਾ ਕਰਦੇ ਹੋ ਸ਼ਾਮ ਨੂੰ ਕਰਦੇ ਹੋ ਸ਼ਾਬਾਸ਼ ਸ਼ਾਬਾਸ਼ ਹੋਰ ਕੀ ਕੀ ਕਰਦੇ ਹੋ ਫਿਰ ਐਕਟੀਵਿਟੀਆਂ ਦੇ ਵਿੱਚ ਜਾ ਕੇ ਸਿੱਧਾ ਖੇਡਣ ਲੱਗ ਜਾਂਦੇ ਹੋ ਠੀਕ ਹੈ ਓਕੇ ਕਿੰਨਾ ਟਾਈਮ ਵਾਰਮ ਅੱਪ ਕਰਦੇ ਹੋ ਵੀਹ ਤੋਂ ਪੱਚੀ ਮਿੰਟ ਠੀਕ ਚਾਲੀ ਮਿੰਟ ਕਿਹੜੀ ਗੇਮ ਖੇਡਦੇ ਹੋ ਬਾਸਕਿਟਬਾਲ ਠੀਕ ਹੈ ਕਿੰਨਾ ਟਾਈਮ ਹੋ ਗਿਆ ਖੇਡਦਿਆਂ ਨੂੰ ਅੱਛਾ ਫਿਰ ਤੁਹਾਡਾ ਵੁਡਨ ਪੋਰਟ ਆ ਕਿ ਦੂਜਾ ਫਲੋਰ ਐਗਾ ਵੁਡਨ ਨਹੀਂ ਹੈਗਾ ਪੱਕੇ ਫ਼ਰਸ਼ 'ਤੇ ਖੇਡਦੇ ਹੋ ਠੀਕ ਹੈ ਠੀਕ ਹੈ ਫਿਰ ਸੂਜ ਵਗੈਰਾ ਤੁਸੀਂ ਪ੍ਰੋਪਰ ਰੱਖੇ ਹੋਣਗੇ ਹਾਂ ਦੇਖੋ ਜਦੋਂ ਤੁਸੀਂ ਗੇਮ ਕਰਨੀ ਆ ਉਹ ਵੀ ਕੰਕਰੀਟ ਵਾਲੇ ਫਰਸ਼ 'ਤੇ ਤਾਂ ਤੁਹਾਨੂੰ ਸੂਜ ਵਗੈਰਾ ਤੁਹਾਡੇ ਪ੍ਰੋਪਰ ਹੋਣੇ ਚਾਹੀਦੇ ਆ ਕਿਟ 'ਚ ਜਾਂਦੇ ਹੋਣਗੇ ਕੀ ਚੂਜ਼ ਕਰਦੇ ਹੋ ਤੁਸੀਂ ਲੋਰ ਪਾਉਂਦੇ ਹੋ ਜਾਂ ਨਿੱਕਰ ਪਾ ਕੇ ਸ਼ੋਟਸ ਸੈਂਡੋ 'ਚ ਅਤੇ ਕਿੰਨੇ ਪਲੇਅਰ ਹੁੰਦੇ ਹੈ ਬਾਸਕਿਟਬਾਲ 'ਚ ਟੋਟਲ ਬਾਰਾਂ ਹੁੰਦੇ ਸਪੇਅਰ ਕਿੰਨੇ ਹੋ ਗਏ ਸੱਤ ਸਪੇਅਰ ਹੋ ਗਏ ਠੀਕ ਹੈ ਠੀਕ ਹੈ ਚਲੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਇਸੇ ਤਰ੍ਹਾਂ ਹੀ ਆਪਣੀ ਪ੍ਰੈਕਟਿਸ ਜਾਰੀ ਰੱਖੋ ਕੋਈ ਵੀ ਜ਼ਰੂਰਤ ਹੋਈ ਤਾਂ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ ਕੋਈ ਖੇਡ ਬਾਰੇ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਮੇਰੇ ਤੋਂ ਪੁੱਛ ਸਕਦੇ ਹੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬੇਟਾ